ਜਿਹੜਾ ਸਾਡਾ ਰੋਪੜ ਹੈ ਬਹੁਤ ਛੋਟਾ ਜਿਹਾ ਇੱਕ ਜ਼ਿਲ੍ਹਾ ਹੈ ਇਹਦੇ ਵਿੱਚੋਂ ਪਹਿਲਾਂ ਬਹੁਤ ਨਵਾਂ ਸ਼ਹਿਰ ਹੋ ਗਿਆ ਮੋਹਾਲੀ ਹੋ ਗਿਆ ਇਹਦੇ ਨਾਲ ਮਿਲਦੇ ਸੀ ਪਰ ਇਹਨਾਂ ਨੂੰ ਜਿਹੜੀਆਂ ਅੱਜ ਦੀਆਂ ਸਰਕਾਰਾਂ ਜਿਹੜੀਆਂ ਸਾਡੀ ਰਾਜਨੀਤੀ ਹੈ ਇਹਨੂੰ ਵੱਖ ਕਰਕੇ ਤਿੰਨ ਜ਼ਿਲ੍ਹੇ ਬਣਾ ਦਿੱਤੇ ਨਵਾਂ ਸ਼ਹਿਰ ਰੋਪੜ ਔਰ ਮੋਹਾਲੀ ਜਿਹੜਾ ਇਹ ਇੱਕ ਜ਼ਿਲ੍ਹਾ ਸੀ ਠੀਕ ਹੈ ਅਤੇ ਬਹੁਤ ਸਾਰੀਆਂ ਸੁਵਿਧਾਵਾਂ ਸੀਗੀਆਂ ਪਰ ਹੁਣ ਜਿਹੜਾ ਹੁਣ ਅਸੀਂ ਦੇਖਦੇ ਹਾਂ ਰੋਪੜ ਬਿਲਕਲ ਜਿਹਨੂੰ ਅਸੀਂ ਕਹਿ ਸਕਦੇ ਹਾਂ ਪੱਛੜਿਆ ਹੋਇਆ ਇਲਾਕਾ ਹੈ ਇਸਦੇ ਵਿੱਚ ਕੋਈ ਵੀ ਸੁਵਿਧਾ ਨਹੀਂ ਹੈ ਜਿੰਨੇ ਮਰਜ਼ੀ ਰਾਜਨੀਤਿਕ ਜਾਂ ਜਿੰਨੇ ਵੀ ਸਾਡੇ ਸਮਾਜ ਸੇਵੀ ਹਨ ਕੋਈ ਵੀ ਰੋਪੜ ਦੇ ਨਾਲ ਕੋਈ ਵੀ ਇਹ ਸਾਰੇ ਜਿਹੜੇ ਵੀ ਹਨ ਇਹ ਸਾਰੇ ਮਤਰੇਈ ਮਾਂ ਵਾਲਾ ਸਲੂਕ ਕਰਦੇ ਹਨ ਇਸ ਲਈ ਅਸੀਂ ਜੋ ਵੀ ਹੈ ਅਸੀਂ ਬਿਲਕੁਲ ਪੱਛੜੇ ਹੋਏ ਹਾਂ